ਪੰਜਾਬ ਦੇ ਕਾਰੋਬਾਰਾਂ 'ਤੇ ਪਰਵਾਸ ਦਾ ਕਾਫੀ ਪ੍ਰਭਾਵ ਪੈ ਰਿਹਾ ਹੈ ਬਹੁਤ ਸਾਰੇ ਲੋਕ ਕੰਮ ਦੇ ਲਈ ਵਿਦੇਸ਼ ਜਾਂ ਵੱਡੇ ਸ਼ਹਿਰਾਂ ਵੱਲ ਜਾ ਰਹੇ ਹਨ ਜਿਸ ਨਾਲ ਰੁਜ਼ਗਾਰ ਦੀ ਘਾਟ ਅਤੇ ਸਥਾਨਕ ਅਰਥਵਿਵਸਥਾ 'ਤੇ ਦਬਾਅ ਪੈ ਰਿਹਾ ਹੈ ਇਸ ਕਾਰਨ ਕਾਰੋਬਾਰਾਂ ਨੂੰ ਮਜ਼ਦੂਰੀ ਦੀ ਘਾਟ ਅਤੇ ਖਪਤਕਾਰਾਂ ਦੀ ਗਿਣਤੀ 'ਚ ਵੀ ਕਮੀ ਆ ਰਹੀ ਹੈ ਇਸ ਨਾਲ ਨਜਿੱਠਣ ਲਈ ਸਥਾਨਕ ਸਰਕਾਰਾਂ ਨੂੰ ਨੌਕਰੀਆਂ ਦੇ ਮੌਕੇ ਬਣਾਉਣ ਅਤੇ ਖੇਤੀਬਾੜੀ ਜਾਂ ਛੋਟੇ ਕਾਰੋਬਾਰਾਂ ਲਈ ਤਕਨਾਲੋਜੀ ਦੇ ਸਹਾਰੇ ਨਵੇਂ ਮਾਰਕਿਟ ਬਣਾਉਣ ਦੀ ਲੋੜ ਹੈ ਇਸ ਤਰ੍ਹਾਂ ਪਰਵਾਸ ਦਾ ਨੈਗਟਿਵ ਪ੍ਰਭਾਵ ਘਟਾਇਆ ਜਾ ਸਕਦਾ ਹੈ ਅਤੇ ਸਥਾਨਕ ਆਰਥਿਕਤਾ ਨੂੰ ਫਾਇਦਾ ਵੀ ਪਹੁੰਚਾਇਆ ਜਾ ਸਕਦਾ ਹੈ